ਜਦੋਂ ਕੋਈ ਵੀ ਵਿਅਕਤੀ ਭਾਰ ਘਟਾਉਣ ਦੀ ਕੋਸ਼ਿਸ਼ ਕਰਦਾ ਹੈਗਾ ਉਹਦੇ ਲਈ ਸਭ ਤੋਂ ਵਧੀਆ ਅਤੇ ਬਹੁਤ ਹੀ ਮਹੱਤਵਪੂਰਨ ਵਿਚਾਰ ਇਹ ਹੋ ਸਕਦਾ ਗਾ ਵੀ ਉਸਨੂੰ ਆਪਣੇ ਭਾਰ ਦੇ ਮੁਤਾਬਿਕ ਪਾਣੀ ਪੀਣਾ ਸ਼ੁਰੂ ਕਰਨਾ ਚਾਹੀਦਾ ਅਤੇ ਉਸ ਨੂੰ ਇੱਕ ਚੰਗੀ ਬੈਲੈਂਸਡ ਡਾਇਟ ਖਾਣੀ ਚਾਹੀਦੀ ਹੈ ਜਿਹਦੇ ਵਿੱਚ ਕੀ ਹੈ ਆਪਾਂ ਹਰੀਆਂ ਸਬਜ਼ੀਆਂ ਫ਼ਲ ਜੂਸ ਚੰਗੀ ਦਾਲ ਜਿਸ ਤੋਂ ਸਾਨੂੰ ਪ੍ਰੋਟੀਨ ਮਿਲ ਸਕਦਾ ਉਹ ਖਾਣੇ ਸ਼ੁਰੂ ਕਰਨੇ ਚਾਹੀਦੇ ਨੇ ਅਤੇ ਤਾਂ ਕਿ ਕੀ ਹੈ ਜਦੋਂ ਆਪਣੇ ਖਾਣ ਪੀਣ ਦੇ ਵਿੱਚ ਆਦਤਾਂ 'ਚ ਸੁਧਾਰ ਹੋ ਜੂਗਾ ਆਪਣੀ ਚੰਗੀ ਬੈਲੈਂਸ ਡਾਇਟ ਹੋ ਜੂਗੀ ਉਹਦੇ ਨਾਲ ਆਪਣਾ ਭਾਰ ਘਟਣਾ ਐਟੋਮੈਟਿਕ ਸ਼ੁਰੂ ਹੋ ਜੂਗਾ ਦੂਜੇ ਨੰਬਰ 'ਤੇ ਕੀ ਹੈਗਾ ਵੀ ਆਪਾਂ ਬਹੁਤ ਸਾਰੀਆਂ ਡ੍ਰਿੰਕ ਨੈਚੁਰਲੀ ਤਰੀਕੇ ਨਾਲ ਬਣਾ ਸਕਦੇ ਹਾਂ ਘਰ ਘਰੇਲੂ ਉਪਚਾਰ ਇਹ ਨੇ ਵੀ ਆਪਾਂ ਇੱਕ ਤੁਲਸੀ ਨੂੰ ਇੱਕ ਡਰਿੰਕ ਦੇ ਤੌਰ 'ਤੇ ਪੀ ਸਕਦੇ ਹੈਗੇ ਤੁਲਸੀ ਕੀ ਹੈ ਆਪਣੇ ਸਰੀਰ ਨੂੰ ਡੀਟੋਕਸ ਕਰਦੀ ਹੈਗੀ ਜਿਹਦੇ ਨਾਲ ਕੀ ਹੈ ਆਪਣਾ ਭਾਰ ਘਟਣਾ ਸ਼ੁਰੂ ਹੋ ਜਾਂਦਾ ਹੈਗਾ ਅਤੇ ਹੋਰ ਬਹੁਤ ਸਾਰੇ ਤਰੀਕੇ ਨੇ ਭਾਰ ਘਟਾਉਣ ਦੇ ਵੀ ਆਪਾਂ ਸੁਬਾਹ ਉੱਠ ਕੇ ਖਾਲੀ ਪੇਟ ਥੋੜ੍ਹਾ ਜਿਹਾ ਗੁਣਗੁਣਾ ਪਾਣੀ ਪੀਣਾ ਸ਼ੁਰੂ ਕਰ ਦੀਏ ਅਤੇ ਕਈ ਲੋਕ ਤਾਂ ਕੀ ਕਰਦੇ ਨੇ ਵੀ ਖਾਲੀ ਪੇਟ ਕੀਆ ਸੀਡਸ ਨੂੰ ਸ਼ਾਮ ਨੂੰ ਭਿਓਂਦੇ ਨੇ ਅਤੇ ਸੁਬਾਹ ਉੱਠ ਕੇ ਪੀਂਦੇ ਨੇ ਉਹਦੇ ਨਾਲ ਵੀ ਆਪਣਾ ਭਾਰ ਦੇ ਵਿੱਚ ਆਪਣੀ ਸਕਿਨ ਦੇ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਜਾਂਦਾ ਹੈਗਾ ਗੱਲ ਇਹ ਹੈਗੀ ਵੀ ਆਪਾਂ ਭਾਰ ਘਟਾਉਣ ਦੀ ਕੋਸ਼ਿਸ਼ ਜੋ ਵੀ ਕਰ ਰਿਹਾ ਹੈਗਾ ਉਹਨੂੰ ਆਪਣੇ ਘਰੇਲੂ ਉਪਾਅ ਇਹ ਸਾਰੇ ਕਰਨੇ ਚਾਹੀਦੇ ਨੇ ਅਤੇ ਜਿਹਦੇ ਨਾਲ ਕੀ ਹੈ ਆਪਣਾ ਭਾਰ ਘਟਣਾ ਹੌਲੀ ਹੌਲੀ ਸ਼ੁਰੂ ਹੋ ਜੂਗਾ ਉਹਦਾ ਕਾਰਨ ਇਹ ਵੀ ਹੈ ਜੇ ਆਪਾਂ ਕਹੀਏ ਵੀ ਇੱਕੋ ਦਮ ਭਾਰ ਨਹੀਂ ਘਟਦਾ ਹੈਗਾ ਭਾਰ ਹੌਲੀ ਹੌਲੀ ਘਟਦਾ ਜਿਵੇਂ ਵਧਿਆ ਉਵੇਂ ਹੀ ਘਟੂਗਾ ਇਸ ਕਰਕੇ ਆਪਾਂ ਨੂੰ ਘਰੇਲੂ ਉਪਚਾਰਾਂ ਨਾਲ ਹੀ ਭਾਰ ਘਟਾਉਣਾ ਚਾਹੀਦਾ ਹੈਗਾ ਘਰੇਲੂ ਨੁਸਖਿਆਂ ਨਾਲ ਭਾਰ ਘਟਾਉਣਾ ਚਾਹੀਦਾ ਨਾ ਕਿ ਕੋਈ ਪ੍ਰੋਡਕਟ ਵਗੈਰਾ ਯੂਜ਼ ਕਰਕੇ ਕਿਉਂਕਿ ਘਰੇਲੂ ਨੁਸਖੇ ਹੁੰਦੇ ਨੇ ਜਿਹੜੇ ਉਹ ਬਹੁਤ ਹੀ ਕਾਰਗਰ ਹੁੰਦੇ ਨੇ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਘਰੇਲੂ ਨੁਸਖੇ ਬਹੁਤ ਵਧੀਆ ਨੇ ਧੰਨਵਾਦ ਜੀ